ਇਸ ਖੇਤਰ ਦੇ ਜਿਹੜੇ ਲੋਕ ਗੀਤ ਹਨ ਉਹਨਾਂ ਵਿੱਚ ਇੱਕ ਨਾਨਕਾ ਮੇਲ ਦਾਦਕਾ ਮੇਲ ਕਿੱਥੇ ਗਈਆਂ ਲਾੜਿਆ ਤੇਰੀਆਂ ਨਾਨਕੀਆਂ ਕਿੱਥੇ ਗਿਆ ਲਾੜਿਆ ਤੇਰੀਆਂ ਨਾਨਕੀਆਂ ਨਾਨਕਾ ਮੇਲ ਖਾਂਦੇ ਸੀ ਖਜੂਰ ਜੰਮੇ ਸੀ ਸੂਰ ਖਾਂਦੇ ਸੀ ਖੀਰੇ ਜੰਮੇ ਸੀ ਹੀਰੇ ਦਾਦਕਾ ਮੇਲ ਇਹ ਸਾਰੇ ਕੁਛ ਐਸੇ ਲੋਕ ਗੀਤ ਹਨ ਜਿਹੜੇ ਇਹਨਾਂ ਵਿੱਚ ਗਾਏ ਜਾਂਦੇ ਹਨ